ਪਿੰਡਾਂ ਦੇ ਲੋਕ ਜਿਹੜੇ ਨੈਟਵਰਕ ਤੋਂ ਦੂਰ ਹਨ ਉਹਨਾਂ ਬਾਰੇ ਸਾਨੂੰ ਜਾਣਕਾਰੀ ਨਹੀਂ ਮਿਲਦੀ ਉਹਨਾਂ ਦਾ ਖਾਣ ਪਾਣ ਉਹਨਾਂ ਦੀ ਸੱਭਿਅਤਾ ਮੀਡੀਆ ਦੀ ਕਵਰੇਜ ਤੋਂ ਬਾਹਰ ਹਨ ਮੀਡੀਆ ਦੀ ਕਵਰੇਜ ਤੋਂ ਬਾਹਰ ਹਨ